ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਹਾਂਜੀ ਹਾਂਜੀ ਮੈਮ

ਨਹੀਂ ਅਸੀਂ ਤਾਂ ਵੈਸੇ ਮੈਮ ਛੱਡਿਆ ਹੋਇਆ ਹੈ ਜੀ ਪਾਣੀ ਸਾਰੇ ਪਿੰਡਾਂ 'ਚ ਇੱਧਰ ਤੁਹਾਡੇ ਨਹੀਂ ਹੋਰ ਪਿੰਡ ਤੋਂ ਸਾਨੂੰ ਇੱਦਾਂ ਦੀ ਕੋਈ ਸ਼ਿਕਾਇਤ ਨਹੀਂ ਆ ਰਹੀ ਵੈਸੇ ਤਾਂ ਤੁਹਾਡੇ ਪਿੰਡ ਤੋਂ ਹੀ ਆ ਰਹੀ ਹੈ ਜੀ ਤੁਸੀਂ ਕਰ ਰਹੇ ਹੋ ਵੈਸੇ ਸਪੈਸ਼ਲੀ ਤਾਂ ਤੁਹਾਡੇ ਪਿੰਡ 'ਚ ਹੀ ਹੈ ਜਾਂ ਫਿਰ ਤੁਸੀਂ ਤੁਹਾਡੇ ਪਿੰਡ 'ਚ ਹੀ ਹੈ ਜਾਂ ਫਿਰ ਤੁਹਾਡੇ ਘਰ ਹੈ ਜੀ ਇਹ ਪ੍ਰੋਬਲਮ ਤੁਹਾਨੂੰ ਹੈ ਜੀ ਤੁਸੀਂ ਨਾ ਜੀ ਜਾਂ ਫਿਰ ਇੱਕ ਵਾਰੀ ਵੈਸੇ ਆਪਣੇ ਪਲੰਬਰ ਨੂੰ ਚੈੱਕ ਕਰਵਾ ਲਉ ਆਪਣਾ ਅਗਰ ਤੁਹਾਡੇ ਘਰ 'ਚ ਹੀ ਹੈ ਵੈਸੇ ਇੱਦਾਂ ਜਾਂ ਫਿਰ ਤੁਸੀਂ ਕਨਫਰਮ ਕਰ ਲਉ ਕਿ ਤੁਹਾਡੇ ਹੀ ਹੈ ਜਾਂ ਫੇਰ ਪਿੰਡ 'ਚ ਹੀ ਹੈ ਇੱਦਾਂ ਦੀ ਸਮੱਸਿਆ ਸਾਰੀ ਆ ਰਹੀ ਅੱਛਾ ਹਾਂਜੀ ਕੋਈ ਗੱਲ ਨਹੀਂ ਜੀ ਹਾਂਜੀ ਆਪਾਂ ਹਾਂਜੀ ਸਾਡੀ ਟੀਮ ਜਾਂਦੀ ਹੈ ਜੀ ਵੈਸੇ ਤਾਂ ਤੁਹਾਡੇ ਵੀ ਆਈ ਹੋਵੇਗੀ ਜੀ ਤੁਹਾਨੂੰ ਦਿੱਤੀਆਂ ਹੋਣੀਆਂ ਜੀ ਗੋਲੀਆਂ ਪ੍ਰੋਵਾਈਡ ਕੀਤੀਆਂ ਹੋਣਗੀਆਂ ਜਾਂ ਫਿਰ ਅਗਰ ਤੁਹਾਡੇ ਪਿੰਡ ਨਹੀਂ ਪਹੁੰਚੀ ਤਾਂ ਟੀਮ ਤੁਹਾਡੇ ਪਿੰਡ ਪਹੁੰਚ ਜੇਗੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਆਪਾਂ ਆਪਣੀ ਟੀਮ ਭੇਜ ਦੇਵਾਂਗੇ ਤੁਹਾਡੇ ਹੈ ਨਾ ਹਾਂਜੀ ਤੁਹਾਡੀ ਸਮੱਸਿਆ ਦਾ ਹੱਲ ਹੋ ਜੇਗਾ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਆਪਾਂ ਭੇਜਦੇ ਹਾਂ ਆਪਣੀ ਟੀਮ ਤੁਹਾਡੇ ਆ ਹੀ ਜਾਵੇਗੀ ਹਾਂਜੀ ਉਕੇ